ਸਾਡੇ ਸੱਭਿਆਚਾਰ ਵਿੱਚ ਹਰੇਕ ਵਰਗ ਇਸ ਮਹਾਂਮਾਰੀ ਬਾਰੇ ਜਾਣੂ ਹੈ ਅਤੇ ਹਰੇਕ ਪਿੰਡ ਸ਼ਹਿਰ ਵਿੱਚ ਵੱਖ ਵੱਖ ਡਿਸਪੈਂਸਰੀਆਂ ਅਤੇ ਡੋਕਟਰਸ ਦੀ ਟੀਮ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਵੀ ਰੁਕਾਵਟ ਨਹੀਂ ਆਉਂਦੀ ਕਿ ਜਿਸ ਕਰਕੇ ਮਹਾਂਮਾਰੀ ਦੌਰਾਨ ਔਰਤਾਂ ਪ੍ਰੇਸ਼ਾਨ ਹੋਣ ਅਤੇ ਹਰ ਇੱਕ ਨੂੰ ਇਸ ਦੀ ਹਰ ਤਰ੍ਹਾਂ ਦੀ ਜਾਣਕਾਰੀ ਨੈੱਟ ਰਾਹੀਂ ਘਰ ਜਾ ਕੇ ਡੋਕਟਰਸ ਰਾਹੀਂ ਦਿੱਤੀ ਜਾਂਦੀ ਹੈ ਅਤੇ ਉਹ ਹਰ ਤਰ੍ਹਾਂ ਨਾਲ ਇਸ ਦਾ ਇਲਾਜ ਕਰਵਾਉਣ ਲਈ ਹਰ ਦਮ ਤਿਆਰ ਰਹਿੰਦੇ ਹਨ